ਭਾਰਤ ਵਿੱਚ ਡਾਂਸਰਾਂ ਅਤੇ ਬਾਲੀਵੁੱਡ ਐਕਟਰਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਕਿਉਂਕਿ ਭਾਰਤ ਦੇ ਬੋਲੀਵੁੱਡ ਐਕਟਰ ਅਤੇ ਡਾਂਸਰਾਂ ਨੂੰ ਹੀ ਦੇਖ ਕੇ ਸਾਡੇ ਦੇਸ਼ ਦੇ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਵੱਲ ਪ੍ਰਭਾਵਿਤ ਹੁੰਦੇ ਹਨ ਅਤੇ ਇਨ੍ਹਾਂ ਦੀ ਤਰ੍ਹਾਂ ਹੀ ਬਣਨਾ ਚਾਹੁੰਦੇ ਹਨ ਇਨ੍ਹਾਂ ਦੀ ਤਰ੍ਹਾਂ ਹੀ ਐਕਟਿੰਗ ਕਰਨਾ ਚਾਹੁੰਦੇ ਹਨ ਇਨ੍ਹਾਂ ਦੀ ਤਰ੍ਹਾਂ ਹੀ ਡਾਂਸ ਕਰਨਾ ਚਾਹੁੰਦੇ ਹਨ ਅਤੇ ਅੱਗੇ ਆਉਣਾ ਚਾਹੁੰਦੇ ਹਨ ਅਤੇ ਆਪਣੇ ਫੈਨਸ ਬਣਾਉਣਾ ਚਾਹੁੰਦੇ ਹਨ ਹਰ ਕਿਸੇ ਨੂੰ ਅੱਜ ਕੱਲ੍ਹ ਫੈਨਸ ਦਾ ਹੀ ਹੈ ਕਿ ਸਾਡੇ ਫੈਨਸ ਬਹੁਤ ਜ਼ਿਆਦਾ ਹੋਣ ਇਸ ਕਰਕੇ ਹੀ ਇਹ ਬੋਲੀਵੁੱਡ ਦਾ ਬਹੁਤ ਹੀ ਵੱਡਾ ਰੋਲ ਅਦਾ ਕਰਦੀ ਹੈ ਆਪਣੇ ਵੱਲ ਖਿੱਚਣ ਲਈ ਅਗਰ ਜੇਕਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਕਿਹੜੇ ਗੀਤ ਜ਼ਿਆਦਾਤਰ ਬੋਲੇ ਜਾਂਦੇ ਹਨ ਅਤੇ ਉਨ੍ਹਾਂ ਦੇ ਵਿੱਚੋਂ ਪਹਿਲਾ ਗੀਤ ਪੰਜਾਬੀ ਗੀਤ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਪੰਜਾਬੀ ਗੀਤ ਦੇ ਵਿੱਚ ਇਹੋ ਜਿਹਾ ਇੱਕ ਮਾਹੌਲ ਹੁੰਦਾ ਹੈ ਕਿ ਭਾਵੇਂ ਕਿਸੇ ਨੂੰ ਉਸਦੀ ਸਮਝ ਚੰਗੀ ਤਰ੍ਹਾਂ ਆਉਂਦੀ ਹੋਵੇ ਭਾਵੇਂ ਨਾ ਆਉਂਦੀ ਹੋਵੇ ਪਰ ਉਸਦੀ ਜਿਹੜੀ ਟੋਨ ਹੁੰਦੀ ਹੈ ਓਹ ਟੋਨ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਹਰ ਕਿਸੇ ਨੂੰ ਉਸ 'ਤੇ ਨੱਚਣਾ ਹੀ ਪੈਂਦਾ ਹੈ